ਲਿਖਣਾ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਕਲਾ ਹੈ ਲਿਖਤ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਰਾਈਟਿੰਗ ਕਹਿੰਦੇ ਹਾਂ ਇਹ ਤਰ੍ਹਾਂ ਤਰ੍ਹਾਂ ਦੀ ਹੁੰਦੀ ਹੈ ਕੋਪੀਆਂ ਤੋਂ ਲੈ ਕੇ ਕੋਪੀਆਂ ਕਿਤਾਬਾਂ ਨੋਵਲਸ ਵਿੱਚ ਅਸੀਂ ਪੋਈਟਰੀ ਪੜ੍ਹਦੇ ਹਾਂ ਕਹਾਣੀਆਂ ਪੜ੍ਹਦੇ ਹਾਂ ਵੱਡੀਆਂ ਵੱਡੀਆਂ ਨੋਵਲਸ ਪੜ੍ਹਦੇ ਹਾਂ ਜਿਹਨਾਂ ਵਿੱਚ ਪੂ ਪੂਰੀ ਪੂਰੀ ਇੱਕ ਕਿਤਾਬ ਇੱਕ ਕਹਾਣੀ ਹੁੰਦੀ ਹੈ ਫਿਲਮਾਂ ਤੋਂ ਲੈ ਕੇ ਗਾਣਿਆਂ ਤੱਕ ਇਹ ਸਾਰਿਆਂ ਵਿੱਚ ਲਿਖਤ ਬਹੁਤ ਹੀ ਮਹੱਤਵਪੂਰਨ ਇੱਕ ਯੋਗਦਾਨ ਦਿੰਦੀ ਹੈ ਮੈਂ ਵੀ ਬਹੁਤ ਲਿਖਦਾ ਹਾਂ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਮੈਂ ਕਹਾਣੀਆਂ ਤੋਂ ਲੈ ਕੇ ਗਾਣੇ ਸਾਰੇ ਲਿਖੇ ਹੋਏ ਹਨ ਅਤੇ ਮੈਂ ਇਸ ਬਾਰੇ ਲੋਕਾਂ ਕੋਲੋਂ ਫੀਡਬੈਕ ਵੀ ਲੈਂਦਾ ਹਾਂ ਜਿਹੜੇ ਮੇਰੇ ਯਾਰ ਦੋਸਤ ਹੈਗੇ ਆ ਉਹ ਮੇਰੀ ਬਹੁਤ ਮਦਦ ਕਰਦੇ ਹਨ ਮੈਨੂੰ ਫੀਡਬੈਕ ਦੇਣ 'ਚ ਮੇਰੀ ਕਹਾਣੀਆਂ 'ਚ ਮੇਰੀ ਮਾਂ ਬਾਪ ਬਹੁਤ ਮਦਦ ਕਰਦੇ ਹਨ ਮੇਰੀ ਫੀਡਬੈਕ ਦੇਣ 'ਚ ਅਤੇ ਇੱਕ ਵਾਰੀ ਬਹੁਤ ਹੀ ਵੱਡੀ ਮੈਂ ਇੱਕ ਕਹਾਣੀ ਲਿਖੀ ਸੀ ਜਿਹਦੇ ਜਿਹ ਤੋਂ ਮੈਂ ਫੀਡਬੈਕ ਕਾਫੀ ਜਣਿਆਂ ਤੋਂ ਲਿਆ ਆਪਣੇ ਯਾਰਾਂ ਦੋਸਤਾਂ ਤੋਂ ਆਪਣੇ ਮਾਪਿਆਂ ਤੋਂ ਅਤੇ ਕੁਝ ਆਪਣੇ ਕੋਲਜ ਦੇ ਟੀਚਰਾਂ ਤੋਂ ਵੀ ਕੋਲਜ ਨੇ ਦੇ ਟੀਚਰਾਂ ਨੇ ਕਾਫੀ ਵਧੀਆ ਫੀਡਬੈਕ ਦਿੱਤਾ ਐਜ ਵਧੀਆ ਰਾਈਟਰ ਉਹ ਚਾਹੁੰਦੇ ਸੀ ਕਿ ਮੇਰੀ ਕਹਾਣੀ ਵਧੀਆ ਹੋਏ ਵਧੀਆ ਅੱਖਰ ਉ ਉਹਦੇ ਵਿੱਚ ਯੂਜ ਹੋਣ ਅਤੇ ਵਧੀਆ ਵਧੀਆ ਅਸੀਂ ਪੂਰੀ ਕਹਾਣੀ ਦੱਸੀਏ ਗਾਣਿਆਂ ਦੇ ਵਿੱਚ ਅਸੀਂ ਮੈਂ ਵੀ ਬਹੁਤ ਸਾਰੇ ਗਾਣੇ ਲਿਖੇ ਹਨ ਅਤੇ ਮੈਂ ਮੋਸਟਲੀ ਜ਼ਿਆਦਾਤਰ ਮੈਂ ਆਪਣਾ ਕਹਾਣੀਆਂ ਲਿਖਦਾ ਹਾਂ ਜਿਹਦੇ ਵਿੱਚ ਮੈਂ ਉਹਦੀ ਮੂਵੀਆਂ ਬਣਾਉਂਦਾ ਹਾਂ ਮੂਵੀਆਂ ਦੀ ਕਹਾਣੀਆਂ ਤੋਂ ਲੈ ਕੇ ਗਾਣਿਆਂ ਤੱਕ ਮੈਂ ਬਹੁਤ ਹੀ ਇੱਕ ਵੱਡਾ ਯੋਗਦਾਨ ਦਿੱਤਾ ਹੈ ਕਿਉਂਕਿ ਕਹਾਣੀਆਂ ਦੇ ਵਿੱਚ ਅਸੀਂ ਆਪ ਆਪਣੀ ਨਵੀਂ ਦੁਨੀਆ ਕ੍ਰੀਏਟ ਕਰਦੇ ਹਾਂ ਆਪਣੀ ਨਵੀਂ ਦੁਨੀਆ ਬਣਾਉਣਾ ਆਪਣੇ ਨਵੇਂ ਪਾਤਰ ਬਣਾਉਣਾ ਆਪਣੇ ਨਵੇਂ ਯੋਗਦਾਨ ਦੇਣਾ ਇਹ ਵੱਡੀ ਚੀਜ਼ ਹੁੰਦੀ ਹੈ ਮੈਂ ਆਪਣੀ ਲਿਖਤ ਵਿੱਚ ਆਪਣੇ ਕਹਾਣੀਆਂ ਦੇ ਵਿੱਚ ਜਿਹਨਾਂ ਦਾ ਅਸ ਮੈਂ ਸਹਾਰਾ ਲੈਂਦਾ ਹਾਂ ਜਿਹਨਾਂ ਤੋਂ ਮੈਂ ਫੀਡਬੈਕ ਲੈਂਦਾ ਹਾਂ ਉਹ ਫੀਡਬੈਕ ਮੈਨੂੰ ਇਮਪਰੂਵ ਕਰਨ ਵਿੱਚ ਹੈਲਪ ਜ਼ਰੂਰ ਕਰਦਾ ਹੈ ਅਤੇ ਨਾਲ ਦੇ ਨਾਲ ਮੈਂ ਵੀ ਚਾਹੁੰਦਾ ਹਾਂ ਕਿ ਮੇਰਾ ਜਿਹੜਾ ਇਹ ਕ੍ਰੀਏਟਿਵ ਮਾਇੰਡ ਹੈ ਇਹ ਨਾਲ ਦੀ ਨਾਲ ਚੱਲਦਾ ਰਹੇ ਮੈਨੂੰ ਵੱਖਰੀਆਂ ਵੱਖਰੀਆਂ ਪਰਸਪੈਕਟਿਵ ਮਿਲਦੇ ਹਨ ਅਤੇ ਇਹ ਮੈਨੂੰ ਬਹੁਤ ਹੈਲਪ ਕਰਦਾ ਹੈ ਮੈਂ ਗਾਣੇ ਵਿੱਚ ਅਸੀਂ ਬੈਕ ਫੀਡਬੈਕ ਲਿੱਤਾ ਸੀ ਜਿਹਨੇ ਬਹੁਤ ਹੀ ਵੱਡੀਆਂ ਵੱਡਾ ਮੈਨੂੰ ਮਦਦ ਕੀਤੀ ਮੇਰੀ ਅਤੇ ਉਹ ਅੱਜ ਮੈਂ ਉਹਦੀ ਫਿਲਮ ਬਣਾਉਣ ਜਾ ਰਿਹਾ ਹਾਂ ਅਤੇ ਦੁਆ ਹੈਗੀ ਕਿ ਉਹ ਵਧੀਆ ਬਣੇ ਅਤੇ ਸ਼ੁਕਰੀਆ